ਸਤਿ ਸ਼੍ਰੀ ਅਕਾਲ ਜੀ ਜੀ ਹਾਂ ਮੈਂ ਪੰਜਾਬੀ ਦੀ ਕੋਈ ਖੇਤਰੀ ਉਪਭਾਸ਼ਾ ਨਹੀਂ ਹੈ ਪਰ ਮੈਂ ਇਹਨਾਂ ਭਾਸ਼ਾਵਾਂ ਦੇ ਬਾਰੇ ਪ੍ਰਸਿੱਧ ਹਾਂ ਅਤੇ ਉਹਨਾਂ ਬਾਰੇ ਜਾਣਕਾਰੀ ਰੱਖਦਾ ਹਾਂ ਪੰਜਾਬੀ ਇੱਕ ਸੋਹਣੀ ਭਾਸ਼ਾ ਹੈ ਜੋ ਪੰਜਾਬ ਸੂਬਾ ਭਾਰਤ ਅਤੇ ਪਾਕਿਸਤਾਨ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਇਹ ਕਿ ਵਿਚਾਰਸ਼ੀਲ ਅਤੇ ਰੰਗੀਨ ਸਾਹਿਤ ਅਤੇ ਸਰੋਤ ਹੈ ਜਿਸ ਵਿੱਚ ਕਵਿਤਾ ਕਹਾਣੀਆਂ ਅਤੇ ਗੀਤ ਸ਼ਾਮਿਲ ਹਨ ਜਿਸਦਾ ਵਾਤਾਵਰਨ ਰੂਪ ਗੁਰਮੁਖੀ ਲਿਪੀ ਵਿੱਚ ਹੈ ਜੋ ਸਿੱਖ ਧਰਮ ਦੇ ਪ੍ਰਮੁੱਖ ਲਿਪੀ ਦੇ ਰੂਪ ਵਿੱਚ ਪ੍ਰਚਾਰਿਤ ਹੋ ਰਿਹਾ ਜੀ ਮੈਨੂੰ ਹਮੇਸ਼ਾ ਪ੍ਰੇਰਨਾ ਮਿਲਦੀ ਹੈ ਜਦੋਂ ਮੈਂ ਪੰਜਾਬੀ ਸਾਹਿਤ ਸਿਧਾਂਤ ਅਤੇ ਸਭ ਸਭੀਆਂ ਨਾਲ਼ ਜੁੜੀਆਂ ਗੱਲਾਂ ਸੁਣਦਾ ਹਾਂ ਇਸ ਭਾਸ਼ਾ ਦੇ ਗੀਤ ਨੂੰ ਛੂਹ ਲੈਂਦੇ ਹਾਂ ਅਤੇ ਉਸਦੇ ਸਿਰ ਸੈਰਿਜ ਵਿੱਚ ਦਰਸਾਏ ਗਏ ਅਨੁਪਦ ਕਵਿਤਾ ਨੇ ਮੇਰੇ ਅੰਦਰ ਨਵਿਤਾ ਦੀ ਭਾਵਨਾ ਪੈਦਾ ਕੀ ਹੈ ਪੰਜਾਬੀ ਭਾਸ਼ਾ ਸਾਂਝੀ ਅਤੇ ਸਭੀਆਂ ਵਿੱਚ ਮੈਨੂੰ ਇੱਕ ਸਾਂਝਾ ਅਹਿਸਾਸ ਹੈ ਅਤੇ ਇਹ ਵੀ ਦਿਖਾਉਂਦਾ ਹੈ ਕਿ ਦੁ ਭਾਸ਼ਾਵਾਂ ਦੀ ਵਿਦਾਇਤਾਂ ਅਤੇ ਸ਼ੈਲੀਆਂ ਸਾਨੂੰ ਇੱਕ ਦੂਜੇ ਨਾਲ਼ ਜੋੜਦੀਆਂ ਹਨ ਸਾਡੀ ਸਾਂਝੀ ਵਿਰਾਸਤ ਨੂੰ ਸਾਂਝਾ ਕਰਨਾ ਅਲ ਅੰਤਕ ਹੈ ਅਤੇ ਸਾਡੀ ਪਿਆਰੀ ਭਾਸ਼ਾ ਨੂੰ ਸੰਭਾਲਣਾ ਹਮਾਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਦਾ ਹੈ ਸਾਰਿਆਂ ਤੋਂ ਵੱਡਾ ਲਾਭ ਇਹ ਹੈ ਕਿ ਇੱਕ ਦੂਜੇ ਨੂੰ ਸਮਝਣ ਵਿੱਚ ਸਹਾਇਕ ਹੋ ਧੰਨਵਾਦ ਜੀ